ਹੈਲੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਬਿੰਦਰ ਸਿੰਘ ਬੋਲਦਾ ਜੀ ਮਾਨਸਾ ਤੋਂ ਹਾਂਜੀ ਨਿੱਕੀ ਚਾਟ ਭੰਡਾਰ ਤੋਂ ਬੋਲ ਰਹੇ ਹੋ ਨਾ ਹਾਂਜੀ ਹਾਂਜੀ ਬਾਈ ਬਾਈ ਜੀ ਇੱਕ ਅਸੀਂ ਓਰਡਰ ਬੁੱਕ ਕਰਨਾ ਸੀ ਖਾਣੇ ਵਾਸਤੇ ਉਹ ਮੇਰੇ ਯਾਰ ਦੋਸਤ ਜਿਵੇਂ ਅਸੀਂ ਪਹਿਲਾਂ ਵੀ ਆਉਂਦੇ ਰਹਿੰਦੇ ਹਾਂ ਤੁਹਾਡੇ ਕੋਲੋਂ ਖਾਣੇ ਲਿਜਾਂਦੇ ਰਹੇ ਹਾਂ ਖਾਂਦੇ ਵੀ ਰਹਿੰਦੇ ਹਾਂ ਕਈ ਵਾਰ ਖਾ ਕੇ ਗਏ ਹਾਂ ਇੱਥੋਂ ਤੁਹਾਡੇ ਯਾਦ ਹੀ ਹੋਊਗਾ ਮੇਰਾ ਨੰਬਰ ਵੀ ਹਾਂਜੀ ਉਹ ਦੁਬਾਰਾ ਅਸੀਂ ਪਾਰਟੀ ਕਰਨਾ ਚਾਹੁੰਦੇ ਸੀਗੇ ਇੱਥੇ ਜਿਵੇਂ ਕਿ ਲੰਚ ਟਾਈਮ ਦੀ ਜਿਵੇਂ ਤੁਹਾਡੇ ਲੰਚ ਟਾਈਮ ਦੇ ਵਿੱਚ ਹੁੰਦੇ ਨੇ ਨਾ ਦਾਲ ਮੱਖਣੀ ਹੋ ਗਈ ਰਾਇਤਾ ਹੋ ਗਿਆ ਨਾਲ ਸਲਾਦ ਵਗੈਰਾ ਹੋ ਗਿਆ ਅਤੇ ਸ਼ਾਹੀ ਪਨੀਰ ਹੋ ਗਿਆ ਹਾਂਜੀ ਉਹ ਮੇਰੇ ਯਾਰ ਦੋਸਤ ਕਹਿੰਦੇ ਸੀ ਵੀ ਬਹੁਤ ਪਸੰਦ ਆਇਆ ਤੁਹਾਡੇ ਕੋਲ ਉਹੀ ਮੈਨੂੰ ਤੁਹਾਨੂੰ ਯਾਦ ਹੋਊਗਾ ਨਾ ਪੂਰਾ ਹੈਂਜੀ ਹਾਂ ਉਹੀ ਯਾਦ ਹੋਊ ਨਾ ਪੂਰਾ ਤੁਹਾਨੂੰ ਉਹ ਵੀ ਅਸੀਂ ਚਲੋ ਉਹੀ ਸੇਮ ਚੀਜ਼ ਰਿਪੀਟ ਕਰਨਾ ਚਾਹੁੰਦੇ ਸੀਗੇ ਮੇਰੇ ਦੋਸਤ ਆ ਰਹੇ ਨੇਗੇ ਬਾਹਰੋਂ ਜਿਹੜੇ ਮੁੰਡੇ ਪੁਰਾਣੇ ਪੜ੍ਹਦੇ ਸੀ ਮੇਰੇ ਨਾਲ ਪਹਿਲਾਂ ਵੀ ਇੱਕ ਵਾਰੀ ਪਹਿਲਾਂ ਵੀ ਆ ਕੇ ਗਏ ਸੀ ਪਿਛਲੇ ਸਾਲ ਉਹ ਉਹੀ ਸੇਮ ਆਉਣਾ ਚਾਹੁੰਦੇ ਨੇ ਤੁਹਾਡੇ ਕੋਲ ਅਤੇ ਖਿਆਲ ਰੱਖਿਓ ਉਹ ਚੀਜ਼ ਬਾਈ ਜੀ ਵਧੀਆ ਲੰਚ ਕਰਵਾਉਣਾ ਸਾਨੂੰ ਠੀਕ ਆ ਜੀ ਅਸੀਂ ਆ ਰਹੇ ਹਾਂ ਇੱਕ ਦੋ ਦਿਨਾਂ 'ਚ ਤੁਹਾਡੇ ਕੋਲ